ਗਾਇਕੀ ਦੇ ਵਿੱਚ ਰਾਗਾਂ ਦੀ ਬਹੁਤ ਮਹੱਤਤਾ ਹੈ ਸਮੇਂ ਦੇ ਅਨੁਸਾਰ ਰਾਗ ਕੋਈ ਸਵੇਰੇ ਕੋਈ ਸ਼ਾਮ ਨੂੰ ਕੋਈ ਰਾਤ ਨੂੰ ਗਾਏ ਜਾਂਦੇ ਹਨ ਰਾਗਾਂ ਤੋਂ ਬਿਨਾਂ ਕੋਈ ਗਾਇਕੀ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਉਹਦੇ ਬਿਨਾਂ ਗਾਇਕੀ ਤਾਂ ਬੇਕਾਰ ਹੈ ਰਾਗ ਦੇ ਰਾਗ ਨਾਲ ਰਾਗ ਨਾਲ ਤੁਸੀਂ ਅੱਛਾ ਅੱਛੇ ਤੋਂ ਅੱਛੇ ਗੀਤ ਗਾ ਸਕਦੇ ਹੋ